ਮੈਂ ਆਪਣੇ ਸਭ ਤੋਂ ਸੁੰਦਰ ਜਾਂ ਵਿਲੱਖਣ ਚੜ੍ਹਨ ਵਾਲੇ ਸਥਾਨ ਦਾ ਤੁਹਾਡੇ ਨਾਲ ਵਰਣਨ ਕਰਨ ਲੱਗਾ ਹੈਗਾ ਹੈ ਜਦੋ ਮੈਂ ਘਰ ਤੋਂ ਉਥੇ ਬਾਬਾ ਬਾਲਕ ਨਾਥ ਲਈ ਜਾਣ ਲਈ ਗਿਆ ਜਾਂ ਪਹਿਲਾਂ ਤਾਂ ਮੈਂ ਘਰ ਤੋਂ ਰੋਪੜ ਲਈ ਬੱਸ ਲਈ ਅਤੇ ਰੋਪੜ ਤੋਂ ਮੈਂ ਨੰਗਲ ਲਈ ਬੱਸ ਲਈ ਕੰਨੈਕਟਰ ਨੇ ਮੇਰੇ ਤੋਂ ਮੈਂ ਮੈਂ ਕੰਨੈਕਟਰ ਨੂੰ ਪੈਸੇ ਦਿੱਤੇ ਅਤੇ ਉਹਨੇ ਮੈਨੂੰ ਟਿੱਕਟ ਦਿੱਤੀ ਅਤੇ ਉਹਦੇ ਅੱਗੇ ਜਾ ਕੇ ਨੰਗਲ ਜਦੋਂ ਬੱਸ ਪੁੱਜੀ ਤਾਂ ਉਨ੍ਹਾਂ ਨੇ ਮੈਨੂੰ ਉੱਥੇ ਜਾ ਕੇ ਬੱਸ 'ਚੋਂ ਲਾਹ ਦਿੱਤਾ ਜਦੋਂ ਆਪਾਂ ਅੱਗੇ ਨੰਗਲ ਤੋਂ ਆਪਾਂ ਅੱਗੇ ਬਾਬਾ ਬਾਲਕ ਨਾਥ ਦੇ ਉੱਥੇ ਤੱਕ ਉੱਥੇ ਤੱਕ ਆਪਾਂ ਨੇ ਕਿਸ਼ਤੀ ਵਿੱਚ ਗਏ ਕਿਸ਼ਤੀ ਵਿੱਚ ਜਾਣ ਦਾ ਜਦੋਂ ਕਿਸ਼ਤੀ ਵਿੱਚ ਬੈਠੇ ਸੀਗੇ ਆਪਾਂ ਤਾਂ ਮੈਂ ਉੱਥੇ ਉੱਥੇ ਡੈਮ ਵਿੱਚ ਮੱਛੀਆਂ ਵੀ ਦੇਖੀਆਂ ਮਗਰਮੱਛ ਵੀ ਦੇਖੇ ਅਤੇ ਤੈਰਦੇ ਸੱਪ ਵੀ ਦੇਖੇ ਅਤੇ ਹੋਰ ਵੀ ਮੈਂ ਉੱਥੇ ਕਈ ਤਰ੍ਹਾਂ ਦਾ ਐਕਸਪੀਰੀਅਸ ਉੱਥੇ ਲਿਆ ਹੈਗਾ ਹੈ ਉਹ ਤੋਂ ਬਾਅਦ ਜਦੋਂ ਮੈਂ ਆਪਾਂ ਉੱਪਰ ਗਏ ਤਾਂ ਉੱਥੇ ਜਾਣ ਤੋਂ ਬਾਅਦ ਉੱਤਰ ਕੇ ਡੇਰਾ ਬਾਬਾ ਬਾਲਕ ਨਾਥ ਦੇ ਆਪਾਂ ਮੰਦਿਰ ਅਤੇ ਉੱਥੇ ਮੱਥਾ ਟੇਕਣ ਜਾਣਾ ਸੀਗਾ ਉੱਪਰ ਤਾਂ ਉੱਥੇ ਜਾਣ ਦੇ ਆਪਾਂ ਬਾਂਦਰ ਵੀ ਦੇਖੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਦ੍ਰਿਸ਼ ਦੇਖੇ ਮੈਂ ਉੱਥੇ ਉੱਪਰ ਮੱਥਾ ਟੇਕ ਕੇ ਆਉਣ ਤੋਂ ਬਾਅਦ ਜਦੋਂ ਉੱਥੇ ਆਪਾਂ ਨੇ ਸਮਾਨ ਦੀ ਖਰੀਦਦਾਰੀ ਵੀ ਕੀਤੀ ਸਮਾਨ ਦੀ ਖਰੀਦਦਾਰੀ ਕਰਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਣ ਤੋਂ ਬਾਅਦ ਆਪਾਂ ਉੱਥੋਂ ਬਾਅਦ 'ਚ ਘਰ ਆ ਗਏ